ਹੈਲੋ ਹਾਂਜੀ ਸਰ ਅਸੀਂ ਡੀਲਿੰਗ ਦਾ ਕੰਮ ਕਰਦੇ ਹਾਂ ਸਟੇਸ਼ਨਰੀ ਦੱਸੋ ਤੁਹਾਡੀ ਕੀ ਰਿਕੁਐਸਟ ਹੈ ਠੀਕ ਠੀਕ ਹੈ ਤੁਹਾਨੂੰ ਚਾਹੀਦੀ ਸੀ ਜਾਂ ਸਟੇਸ਼ਨਰੀ ਦੀਆਂ ਬੁੱਕਸ ਚਾਹੀਦੀਆਂ ਸੀ ਬੁੱਕਸ ਕਹਿ ਰਹੇ ਹੋ ਕਿ ਤੁਸੀਂ ਪੈਨਸਿਲ ਦਾ ਡੱਬਾ ਏ ਫੋਰ ਸਾਈਜ਼ ਦੇ ਪੇਜਸ ਹੋਰ ਕੀ ਦੱਸਿਆ ਸਰ ਤੁਸੀਂ ਠੀਕ ਹੈ ਸਟੇਸ਼ਨਰੀ ਦਾ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਜਿਹੜਾ ਆਉਂਦਾ ਹੈ ਆਪਣੇ ਕੋਲ ਸਕੇਲਸ ਕੰਪਸ ਡੀ ਦੀ ਪ੍ਰੋਪਰ ਇੱਕ ਉਹ ਜਮੈਟਰੀ ਆਉਂਦੀ ਹੈ ਕਲਰਡ ਸਕੈਚਸ ਵਗੈਰਾ ਸਾਰਾ ਕੁਛ ਸਮਾਨ ਹੁੰਦਾ ਉਹਦੇ ਵਿੱਚ ਹੋਰ ਸਰ ਤੁਸੀਂ ਕਹਿ ਰਹੇ ਹੋ ਬੁੱਕਸ ਸਰ ਤੁਸੀਂ ਕਿਸਦੀ ਗੱਲ ਕਰ ਰਹੇ ਹੋ ਕਲਾਸਸ ਵਾਲੀਆਂ ਜਾਂ ਨੌਰਮਲ ਜਿਹੜੀ ਬੁੱਕਸ ਨੇ ਠੀਕ ਠੀਕ ਹੈ ਠੀਕ ਹੈ ਸਰ ਤੁਹਾਡਾ ਮੈਨੂੰ ਦੱਸ ਸਕਦੇ ਹੋ ਬੋਰਡ ਕਿਹੜਾ ਬੱਚਿਆਂ ਦਾ ਪੰਜਾਬ ਬੋਰਡ ਦੀਆਂ ਚਾਹੀਦੀਆਂ ਠੀਕ ਹੈ ਸਰ ਮਿਲ ਜਾਣਗੀਆਂ ਸਰ ਸਾਰੀ ਤੁਹਾਨੂੰ ਬੁੱਕਸ ਪ੍ਰੋਵਾਈਡ ਕਰ ਦੇਵਾਂਗੇ ਅਸੀਂ ਪ੍ਰੋਪਰ ਸਾਡੇ ਕੋਲ ਲੱਗੀਆਂ ਨੇ ਹਰ ਇੱਕ ਬੁੱਕ ਬੁੱਕ ਹੈਗੀ ਨੋਵਲਸ ਵੀ ਹੈਗੀਆਂ ਨੇ ਸਾਡੇ ਕੋਲ ਬਹੁਤ ਸਾਰੀ ਅਤੇ ਤੁਹਾਨੂੰ ਇੰ ਸਾਰੀ ਪੰਜਾਬੀ ਮੀਡੀਅਮ 'ਚ ਹੀ ਚਾਹੀਦੀਆਂ ਨੇ ਜਾਂ ਚਾਹੁੰਦੇ ਹੋ ਕੁਛ ਬੁੱਕਸ ਇੰਗਲਿਸ਼ 'ਚ ਵੀ ਹੋਣ ਠੀਕ ਹੈ ਸਰ ਹਾਂਜੀ ਅਸੀਂ ਪ੍ਰੋਪਰ ਡਿਲਵਰੀ ਕਰਦੇ ਹਾਂ ਅਸੀਂ ਓਡਰ ਲੈਂਦੇ ਫਿਰ ਡਿਲਵਰੀ ਕਰਦੇ ਹਾਂ ਕਿਤੇ ਵੀ ਅਸੀਂ ਇੰਡੀਆ ਨੂੰ ਡਿਲਵਰੀ ਕਰ ਸਕਦੇ ਹਾਂ ਪਰ ਪੰਜਾਬ ਨੂੰ ਵੈਸੇ ਸਰ ਅਸੀਂ ਕਰ ਰਹੇ ਹਾਂ ਪ੍ਰੋਪਰ ਡਿਲਵਰੀ ਪਰ ਪਹਿਲੇ ਸਰ ਤੁਸੀਂ ਇਹ ਦੱਸੋ ਤੁਹਾਡਾ ਅਡਰੈਸ ਕੀ ਹੈ ਮੈਨੂੰ ਤੁਸੀਂ ਉਸ ਹਿਸਾਬ ਤੁਹਾਨੂੰ ਅਸੀਂ ਦੱਸਾਂਗੇ ਕਦੋਂ ਤੁਹਾਡੀ ਡਿਲਵਰੀ ਹੋਏਗੀ ਤੁਹਾਡਾ ਅਡਰੈਸ ਦੱਸੋ ਸਾਨੂੰ ਕਿੱਥੇ ਤੁਸੀਂ ਰਹਿੰਦੇ ਹੋ

ਠੀਕ ਹੈ ਫਾਜ਼ਿਲਕਾ ਬੋਇ ਸਕੂਲ ਚਾਹੀਦੀਆਂ ਹੋਣਗੀਆਂ ਸਰਕਾਰੀ ਠੀਕ ਹੈ ਸਰ ਉਹ ਅਸੀਂ ਲੁਧਿਆਣਾ ਤਾਂ ਅਸੀਂ ਵੈਸੇ ਕਰਦੇ ਹਾਂ ਸਾਡਾ ਅਸੀਂ ਤਿੰਨ ਦਿਨ ਦੇ ਅੰਦਰ ਅੰਦਰ ਸਾਰਾ ਅਸੀਂ ਓਡਰ ਪੂਰਾ ਪੈਕ ਕਰਕੇ ਤੁਹਾਨੂੰ ਅਸੀਂ ਪਹੁੰਚਾ ਦੇਵਾਂਗੇ ਕੋਈ ਵੀ ਤੁਹਾਨੂੰ ਇਸ਼ੂ ਨਹੀਂ ਆਏਗਾ ਜਿਵੇਂ ਸਰ ਤੁਸੀਂ ਦੱਸਿਆ ਤੁਸੀਂ ਸ ਸਟੇਸ਼ਨਰੀ ਲੈਣੀ ਸਾਰੇ ਬੱਚਿਆਂ ਦੀ ਬੁੱਕਸ ਲੈਣੀਆਂ ਨੇ ਪੈੱਨ ਅਤੇ ਸਾਰਾ ਕੁਛ ਤੁਹਾਨੂੰ ਲੈਣਾ ਕੁਛ ਸਾਈਜ ਦੇ ਪੇਜਸ ਵੀ ਲੈਣੇ ਦੋ ਬੰਡਲ ਇਹ ਸਰ ਤੁਹਾਡਾ ਪੈ ਜਾਵੇਗਾ ਫਿਫਟੀਨ ਥਾਊਸੇਂਡ ਤੁਹਾਡਾ ਖਰਚਾ ਹੋਏਗਾ ਉਹ ਸਰ ਤੁਹਾਡੇ ਕੋਲ ਓਪਸ਼ਨ ਹੈ ਜੀ ਐੱਸ ਟੀ ਜੀ ਐੱਸ ਟੀ ਨੰਬ ਜੀ ਐੱਸ ਟੀ ਨੰਬਰ ਤੁਹਾਡੇ ਕੋਲ ਅਸੀਂ ਉਹ ਵੀ ਲਾ ਦੇਵਾਂਗੇ ਅਗਰ ਤੁਹਾਡੇ ਡਿਸਕਾਊਂਟ ਅਸੀਂ ਉਹ ਵੀ ਕਰ ਦੇਵਾਂਗੇ ਪ੍ਰੋਪਰ ਤੁਹਾਡੇ ਕੋਲ ਵੈਸੇ ਬਿੱਲ ਹੋਵੇਗਾ ਪ੍ਰੋਪਰ ਤੁਹਾਡੇ ਕੋਲ ਹੋਵੇਗਾ ਬਿੱਲ ਨਹੀਂ ਸਰ ਟੈਨਸ਼ਨ ਨਾ ਲਉ ਬਿੱਲ ਤੁਹਾਨੂੰ ਅਸੀਂ ਪ੍ਰੋਪਰ ਪੱਕਾ ਬਿੱਲ ਦੇਵਾਂਗੇ ਅਤੇ ਪ੍ਰੋਪਰ ਓਨ ਟਾਈਮ ਡਿਲਵਰੀ ਹੋਵੇਗੀ ਅਤੇ ਕੋਈ ਵੀ ਇਸ਼ੂ ਆਏ ਤਾਂ ਤੁਸੀਂ ਸਾਨੂੰ ਕੌਲ ਕਰਕੇ ਕਸਟਮਰ ਕੇਅਰ ਨਾਲ ਗੱਲ ਕਰ ਸਕਦੇ ਤੁਹਾਡੀ ਪ੍ਰੋਪਰ ਤੁਹਾਡੀ ਹੈਲਪ ਕੀਤੀ ਜਾਵੇਗੀ ਅਤੇ ਬਾਕੀ ਹਾਂਜੀ ਠੀਕ ਹੈ ਸਰ ਠੀਕ ਹੈ ਸਰ ਬਸ ਤੁਸੀਂ ਆਡਰ ਤੁਹਾਡਾ ਪੱਕਾ ਨਾ ਫਿਰ ਪਹੁੰਚਾ ਦੇਵਾਂਗੇ ਤੁਹਾਨੂੰ ਓਡਰ ਠੀਕ ਹੈ ਸਰ ਥੈਂਕ ਊ